ਵੈਸੇ ਤਾਂ ਜਿਹਦੇ ਵਿੱਚ ਮੈਨੂੰ ਮਤਲਬ ਰੁਚੀ ਹੈ ਉਹਦੇ ਵਿੱਚ ਮਤਲਬ ਡਰ ਡਰਨ ਵਾਲੀ ਗੱਲ ਜਾਂ ਘਬਰਾਹਟ ਵਾਲੀ ਗੱਲ ਤਾਂ ਨਹੀਂ ਹੈ ਪਰ ਜਦੋਂ ਫਸਟ ਟਾਈਮ ਕੋਈ ਵੀ ਸਟੇਜ 'ਤੇ ਜਾਂਦਾ ਤਾਂ ਥੋੜ੍ਹੀ ਜਿਹੀ ਘਬਰਾਹਟ ਔਰ ਡਰ ਤਾਂ ਹੁੰਦਾ ਹੀ ਹੈ ਸਾਡੇ ਸਕੂਲ ਵਿੱਚ ਐਨੂਅਲ ਫੰਕਸ਼ਨ ਸੀ ਮੈਂ ਉਹਦੇ ਵਿੱਚ ਪਾਰਟੀਸਪੇਟ ਲਿਆ ਕਿ ਮੈਂ ਗਾਣਾ ਗਾਵਾਂਗੀ ਜਦੋਂ ਮੈਨੂੰ ਸਟੇਜ 'ਤੇ ਬੁਲਾਇਆ ਗਿਆ ਤਾਂ ਮੈਂ ਸਟੇਜ 'ਤੇ ਗਈ ਜਦੋਂ ਮੈਂ ਸਾਰਿਆਂ ਵੱਲ ਦੇਖਿਆ ਤਾਂ ਉੱਥੇ ਮੇਰੀ ਪ੍ਰਿੰਸੀਪਲ ਮੈਡਮ ਵੀ ਸੀ ਔਰ ਮੇਰੇ ਫਰੈਂਡਸ ਵੀ ਸੀ ਕਾਫੀ ਸਾਰੇ ਅਤੇ ਕਲਾਸਮੇਟਸ ਵੀ ਸੀ ਔਰ ਮੇਰੇ ਅ ਟੀਚਰ ਵੀ ਸੀ ਤਾਂ ਉਹਨਾਂ ਨੂੰ ਦੇਖ ਕੇ ਪਹਿਲੇ ਤਾਂ ਮੈਨੂੰ ਬਹੁਤ ਹੀ ਘਬਰਾਹਟ ਮਹਿਸੂਸ ਹੋਈ ਫਿਰ ਮੈਨੂੰ ਥੋੜ੍ਹਾ ਜਿਹਾ ਡਰ ਲੱਗਿਆ ਪਰ ਫਿਰ ਪ੍ਰਿੰਸੀਪਲ ਸਰ ਨੇ ਮੈਨੂੰ ਦੇਖਿਆ ਕਿ ਮਤਲਬ ਕਿ ਮਤਲਬ ਕਿ ਲੜਕੀ ਘਬਰਾ ਰਹੀ ਹੈ ਤਾਂ ਉਹ ਮੇਰੇ ਮੇਰੇ ਲਾਗੇ ਆਏ ਅਤੇ ਉਹਨਾਂ ਨੇ ਮਤਲਬ ਮੈਨੂੰ ਥੋੜ੍ਹਾ ਜਿਹਾ ਹੌਂਸਲਾ ਦਿੱਤਾ ਅਤੇ ਮੈਂ ਮਤਲਬ ਜਿਹੜਾ ਡਰ ਹੈ ਉਹਨੂੰ ਥੋੜ੍ਹਾ ਜਿਹਾ ਦੂਰ ਕੀਤਾ ਘਬਰਾਹਟ ਨੂੰ ਦੂਰ ਕਰਕੇ ਫਿਰ ਮੈ ਗਾਣਾ ਗਾਉਣਾ ਸ਼ੁਰੂ ਕੀਤਾ ਤਾਂ ਉਹਦਾ ਜਿਹੜਾ ਐਕਸਪੀਰੀਅੰਸ ਆ ਉਹ ਬਹੁਤ ਹੀ ਵਧੀਆ ਰਿਹਾ ਧੰਨਵਾਦ